ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬੋਲੋ ਜੀ ਜੀ ਜੀ ਹਾਂਜੀ ਹਾਂਜੀ ਮਿਲ ਜਾਣਗੇ ਜੀ ਸਾਡੇ ਕੋਲ ਮੈਮ ਫੂਟ ਐਪਲ ਹੈਗੇ ਨੇ ਜੀ ਬਨਾਨਾ ਹੈ ਜੀ ਗਵਾਵਾ ਹੈ ਜੀ ਹਾਂਜੀ ਹਰ ਪ੍ਰਕਾਰ ਦੇ ਫਰੂਟ ਹੈ ਜੀ ਤੁਹਾਨੂੰ ਕੀ ਚਾਹੀਦਾ ਜੀ ਐਪਲ ਮੈਮ ਜਿਹੜੇ ਕਸ਼ਮੀਰੀ ਨੇ ਉਹ ਆਪਣੇ ਕੋਲ ਡੇਢ਼ ਸੌ ਦੇ ਕਰੀਬ ਹੈਗੇ ਨੇ ਅਤੇ ਜਿਹੜੇ ਲੋਕਲ ਹੈ ਉਹ ਵੀ ਹੈ ਜੀ ਆਪਣੇ ਕੋਲ ਹਾਂਜੀ ਹਾਂਜੀ ਫਰੈੱਸ਼ ਨੇ ਜੀ ਹਾਂਜੀ ਹਾਂਜੀ ਮਿਲ ਜਾਣਗੇ ਜੀ ਗਵਾਵਾ ਮੈਮ ਹੈਗਾ ਜੀ ਅੱਸੀ ਕੁ ਰੁਪਏ ਪਰ ਕੇਜੀ ਹੈ ਜੀ ਹਾਂਜੀ ਜੀ ਹਾਂਜੀ ਹੈ ਹਾਂਜੀ ਮਿਲ ਜਾਏਗਾ ਜੀ ਸੱਠ ਕੁ ਰੁਪਏ ਪਰ ਕੇਜੀ ਮਿਲ ਜਾਏਗਾ ਜੀ ਹਾਂਜੀ ਜੀ ਮਿਲ ਜਾਏਗਾ ਜੀ ਹਾਂਜੀ ਕੀਵੀ ਵੀ ਹੈ ਜੀ ਮੈਮ ਕੀਵੀ ਤੁਹਾਨੂੰ ਪਰ ਪੀਸ ਚਾਹੀਦਾ ਜਾਂ ਕਿਵੇਂ ਜੀ ਆਹ ਦਰਜਨ 'ਚ ਚਾਹੀਦਾ ਜੀ ਪਰ ਪੀਸ ਤੁਹਾਨੂੰ ਤੀਹ ਪੈਂਤੀ ਰੁਪਏ ਲੱਗ ਜਾਏਗਾ ਜੀ

ਹਾਂਜੀ ਹਾਂਜੀ ਮੈਮ ਮਿਲ ਜਾਣਗੇ ਜੀ ਪੀਸ ਜੀ ਹਾਂਜੀ ਹੈ ਉਹ ਤੁਹਾਨੂੰ ਅੱਸੀ ਰੁਪਏ ਦਰਜਨ ਮਿਲ ਜਾਣਗੇ ਜੀ ਹਾਂਜੀ ਫਰੈੱਸ਼ ਮਿਲਣਗੇ ਜੀ ਹਾਂਜੀ ਹੋਮ ਡਿਲੀਵਰੀ ਹਾਂਜੀ ਹੋ ਜਾਏਗੀ ਜੀ ਹਾਂਜੀ ਮੈਮ ਠੀਕ ਹੈ ਮੈਮ ਤੁਸੀਂ ਐਡਰੈਸ ਤੁਸੀਂ ਵਟਸਐਪ ਕਰ ਦਿਓ ਅਤੇ ਤੁਹਾਨੂੰ ਹੋਮ ਡਿਲੀਵਰੀ ਮਿਲ ਜਾਏਗੀ ਜੀ ਜੀ ਜੀ ਜੀ ਜੀ ਠੀਕ ਹੈ ਓਕੇ ਜੀ ਓਕੇ ਓਕੇ ਵੈਲਕਮ